ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਸਾਡੇ ਜੋ ਅਲ ਆਸੇ ਪਾਸੇ ਦੇ ਖੇਤਰ ਦੇ ਵਿੱਚ ਕਈ ਜੋ ਹੈ ਇੰਸਟੀਟਿਊਟ ਜੋ ਹੈਗੇ ਆ ਸਥਿਤ ਹਨ ਇਹਨਾਂ ਵਿੱਚ ਕਈ ਯੂਨੀਵਰਸਿਟੀਆਂ ਵੀ ਹਨ ਅਤੇ ਨਾਲ ਨਾਲ ਕਈ ਸੰਸਥਾਵਾਂ ਵੀ ਹਨ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਮਾਈ ਭਾਗੋ ਕਾਲਜ ਜੋ ਕਿ ਰੱਲੇ ਵਿੱਚ ਸਥਿਤ ਹੈ ਉਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ ਮਾਈ ਭਾਗੋ ਕਾਲਜ ਰੱਲਾ ਜੋ ਹੈ ਉੱਥੇ ਜੋ ਹੈ ਇੱਕ ਵੱਖਰੀ ਤਰੀਕ ਕਿਸਮ ਦੀ ਮ ਗੱਲ ਦੇਖਣ ਨੂੰ ਮਿਲਦੀ ਹੈ ਕਿ ਪਹਿਲਾਂ ਉੱਥੇ ਜੋ ਹੈ ਉਹ ਉਹ ਕਾਲਜ ਓਨਲੀ ਲੜਕੀਆਂ ਵਾਲਾ ਸੀ ਲੜਕੀਆਂ ਵਾਲਾ ਅਤੇ ਬਾਅਦ ਵਿੱਚ ਹੁਣ ਉਸ ਵਿੱਚ ਜੋ ਹੈ ਉਹਨੂੰ ਕੰਬਾਇਨ ਕਰ ਦਿੱਤਾ ਹੈ ਪਲੱਸ ਉਹਦੇ ਵਿੱਚ ਹੁਣ ਜੋ ਲੜਕੇ ਆ ਉਹ ਵੀ ਉਹਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਅਤੇ ਜੇ ਦੇਖਿਆ ਜਾਵੇ ਤਾਂ ਇਹ ਇੱਕ ਪ੍ਰਕਾਰ ਦੀ ਚੰਗੀ ਸੋਚ ਵੀ ਹੈ ਕਿਉਂਕਿ ਇਹ ਸਾਡੀ ਪੁਰਾਣੀ ਸੋਚ ਪਰੰਪਰਾਵਾਂ ਦੀ ਸੋਚ ਨੂੰ ਰੂੜੀਵਾਦੀ ਸੋਚ ਨੂੰ ਸਾਡੀ ਨੂੰ ਦੂਰ ਕਰਦਾ ਜੋ ਸਟਿਊਟ ਐਪ ਸੋਚ ਸਕਦੇ ਉਹਨੂੰ ਦੂਰ ਕਰਦਾ ਹੈ ਅਤੇ ਜੋ ਸਾਡੀ ਇਹ ਚੰਗੀ ਸੋਚ ਨੂੰ ਜੋ ਹੈਗਾ ਅੱਗੇ ਬੜਾਵਾ ਦਿੰਦਾ ਗਾ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਅਸੀਂ ਦੇਖਦੇ ਸੀ ਵੀ ਓਨਲੀ ਲੜਕੀਆਂ ਵਾਸਤੇ ਅਲੱਗ ਸਕੂਲ ਕਾਲਜ ਹੈਗੇ ਸੀ ਜਿਹੜੇ ਪ੍ਰੋਵਾਈਡ ਕਰਵਾਏ ਜਾਂਦੇ ਸੀਗੇ ਅਤੇ ਲੜਕੀਆਂ ਵਾਸਤੇ ਅਲੱਗ ਬਟ ਇਹ ਉਹ ਗੱਲ ਨੂੰ ਅੱਜ ਕੱਲ੍ਹ ਜੋ ਹੈਗੇ ਆ ਇਹਨੂੰ ਨਕਾਰਿਆ ਜਾ ਰਿਹਾ ਅਤੇ ਜੋ ਅੱਜ ਕੱਲ੍ਹ ਦੀ ਮਾਡਰਨ ਆਪਾਂ ਕਹੀਏ ਐਜੂਕੇਸ਼ਨ ਪੋਲਸੀ ਹੈ ਉਹ ਵੀ ਸਾਨੂੰ ਇੱਦਾਂ ਹੀ ਸਾਨੂੰ ਕਹਿੰਦੀ ਹੈ ਵੀ ਬੱਚੇ ਕੰਫਰਟੇਬਲ ਹੋ ਕੇ ਜੋ ਹੈਗੇ ਆ ਉਹ ਪੜ੍ਹ ਸਕਣ ਇਸ ਲਈ ਇਹ ਕਾਲਜ ਜੋ ਹੈਗਾ ਇਹਨੂੰ ਕੰਬਾਈਨ ਕੀਤਾ ਗਿਆ ਹੁਣ ਇਹਦੇ ਵਿੱਚ ਲੜਕੇ ਅਤੇ ਲੜਕੀਆਂ ਦੋਨੇ ਇਕੱਠੇ ਪੜ੍ਹ ਸਕਦੇ ਹਨ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਨਜ਼ਦੀਕ ਮਾਤਾ ਸੁੰਦਰੀ ਕਾਲਜ ਮਾਨਸਾ ਹੈ ਉਹ ਵੀ ਬਹੁਤ ਚੰਗਾ ਕਾਲਜ ਹੈ ਉਹਦੇ ਵਿੱਚ ਲੜਕੀਆਂ ਜੋ ਹੈਗੀਆਂ ਉਹ ਚੰਗੀ ਸਿੱਖਿਆ ਪ੍ਰਾਪਤ ਕਰਦੀਆਂ ਨੇ ਇਹ ਜੋ ਹੈਗਾ ਕਾਲਜ ਬੱਸ ਸਟੈਂਡ ਦੇ ਨਜ਼ਦੀਕ ਹੋਣ ਦੇ ਕਾਰਨ ਇਹਦੇ ਵਿੱਚ ਬੱਚਿਆਂ ਨੂੰ ਜੋ ਹੈਗਾ ਆਉਣਾ ਜਾਣਾ ਬਹੁਤ ਜਿਹੜੀ ਆਪਾਂ ਨੂੰ ਜੇ ਆ ਬਹੁਤੀ ਕਠਿਨਾਈ ਨਹੀਂ ਹੁੰਦੀ ਆਸਾਨੀ ਦੇ ਨਾਲ ਜੋ ਹੈ ਬੱਚੇ ਇਹ ਕਾਲਜ ਵਿੱਚ ਜਾ ਸਕਦੇ ਨੇ ਬਹੁਤ ਚੰਗੀ ਇੱਥੇ ਆਪਾਂ ਕਹਿ ਦਈਏ ਵੀ ਪੜ੍ਹਾਈ ਹੁੰਦੀ ਹੈ ਅਤੇ ਨਾਲ ਹੀ ਅੱਗੇ ਮੈਂ ਕਹਿਣ ਦੱਸਣਾ ਚਾਹੁੰਦਾ ਕਿ ਆਹ ਸਾਡੇ ਨਜ਼ਦੀਕ ਐਸ ਡੀ ਕਾਲਜ ਬਰਨਾਲਾ ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਅਸੀਂ ਯੂਨੀਵਰਸਿਟੀਆਂ ਦੀ ਤਾਂ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਨਜ਼ਦੀਕ ਸਾਨੂੰ ਪੈਂਦੀ ਹੈ ਉੱਥੇ ਵੀ ਜੋ ਆਪਾਂ ਕਹਿ ਦਈਏ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਕੋਰਸ ਸਾਨੂੰ ਹੈਗੇ ਆ ਜੋ ਪ੍ਰੋਵਾਈਡ ਕਰਵਾਏ ਜਾਂਦੇ ਨੇ ਚੰਗੀ ਉੱਚੀ ਸਿੱਖਿਆ ਆਪਾਂ ਕਹਿ ਦਈਏ ਉੱਥੇ ਸਾਨੂੰ ਕਰਵਾਈ ਜਾਂਦੀ ਹੈ ਚੰਗੇ ਉੱਥੇ ਕੋਰਸ ਹੈਗੇ ਨੇ ਜਿਹੜੇ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ ਅਤੇ ਉੱਥੇ ਨਾਲ ਨਾਲ ਬੱਚਿਆਂ ਦੇ ਰਹਿਣ ਦਾ ਵੀ ਪ੍ਰੋਪਰ ਜਿਹੜਾ ਹੈਗਾ ਉਹ ਅਰੇਂਜਮੈਂਟ ਹੋਇਆ ਉੱਥੇ ਉੱਥੇ ਨਾਲ ਨਾਲ ਲੜਕੀਆਂ ਵਾਸਤੇ ਜਾਂ ਲੜਕਿਆਂ ਵਾਸਤੇ ਹੋਸਟਲ ਦਾ ਜੋ ਪੀਜੀ ਦਾ ਖਾਸ ਪ੍ਰਬੰਧ ਉੱਥੇ ਜੋ ਕੀਤਾ ਗਿਆ ਹੈਗਾ ਇਸ ਲਈ ਇਹ ਬਹੁਤ ਚੰਗੀ ਜਿਹੜੀ ਹੈਗੀ ਆ ਸੋਚ ਨੂੰ ਅੱਗੇ ਬੜਾਵਾ ਦਿੰਦਾ ਇਸ ਲਈ ਉੱਥੇ ਬਹੁਤ ਹੀ ਕਠਿਨਾਈ ਨਹੀਂ ਹੁੰਦੀ ਇਸ ਲਈ ਅਸੀਂ ਜਿਹੜੇ ਹੈਗੇ ਆ ਆਮ ਤੌਰ 'ਤੇ ਉੱਥੇ ਜਾ ਸਕਦੇ ਹਾਂ ਉੱਥੇ ਰਹਿ ਵੀ ਸਕਦੇ ਹਾਂ ਇੱਥੇ ਬੱਚਿਆਂ ਵਾਸਤੇ ਚੰਗੇ ਤੌਰ 'ਤੇ ਹੋਸਟਲਾਂ ਦਾ ਜਿਹੜਾ ਹੈਗਾ ਆ ਪ੍ਰਬੰਧ ਕੀਤਾ ਗਿਆ ਹੈਗਾ ਅਤੇ ਜਗ੍ਹਾ ਹੋਰ ਦੇਖ ਲਈ ਸਾਡੇ ਨਜ਼ਦੀਕ ਇੱਥੇ ਗੁਰੂ ਕਾਸੀ ਜਿਹੜੀ ਹੈਗੀ ਆ ਯੂਨੀਵਰਸਿਟੀ ਤਲਵੰਡੀ ਸਾਬੋ ਹੈਗੀ ਹੈ ਉੱਥੇ ਵੀ ਜੋ ਵਧੀਆ ਬੱਚਿਆਂ ਵਾਸਤੇ ਬਹੁਤ ਚੰਗਾ ਅਰੇਂਜਮੈਂਟ ਕਰਿਆ ਗਿਆ ਬੱਚਿਆਂ ਦੇ ਆਉਣ ਜਾਣ ਵਾਸਤੇ ਉੱਥੇ ਬੱਸਿਸ ਦੇ ਗਈਆਂ ਉਹ ਵੀ ਪ੍ਰੋਵਾਈਡ ਕੀਆ ਗਈਆਂ ਨੇ ਇ ਇਸੇ ਦੇ ਕਰਕੇ ਕੀ ਹੈ ਬੱਚਿਆਂ ਨੂੰ ਆਉਣ ਜਾਣ ਵਿੱਚ ਬਹੁਤੀ ਕਠਿਨਾਈ ਨਹੀਂ ਹੁੰਦੀ ਇਸ ਕਰਕੇ ਜਿਹੜੇ ਓ ਬੋ ਥੋੜ੍ਹੇ ਮੋਟੇ ਦੂਰ ਦੇ ਇਲਾਕੇ ਦੇ ਬੱਚੇ ਹਨ ਉਹ ਵੀ ਬੜੀ ਆਸਾਨੀ ਦੇ ਨਾਲ ਆਮ ਜੋ ਮੈਂ ਕਾਲਜ ਵਿੱਚ ਬੈਨਾਂ ਲੱਗੀਆਂ ਨੇ ਜਾਂ ਬੱਸਾਂ ਹੈਗੀਆਂ ਨੇ ਉਹਦੇ ਚੰਗੀ ਤਰ੍ਹਾਂ ਆ ਗਿਆ ਆਪਣਾ ਸਫਰ ਜਿਹੜਾ ਹੈਗੇ ਨੇ ਉਹ ਸਕਦੇ ਨੇ